ਇੰਝ ਤਾਂ ਬਥੇਰੀਆਂ ਸਮੱਸਿਆਵਾਂ ਹਨ ਪਠਾਨਕੋਟ ਵਿੱਚ ਪਰ ਕੁਝ ਅਜਿਹੀਆਂ ਸਮੱਸਿਆ ਵੀ ਹਨ ਜੋ ਸਿਰਫ ਸਰਕਾਰ ਹੀ ਹੱਲ ਕਰ ਸਕਦੀਆਂ ਹਨ ਅਤੇ ਸਰਕਾਰ ਹੀ ਉਹਨਾਂ ਸਮੱਸਿਆ ਨੂੰ ਦੇਖ ਦੇਖਰੇਖ ਕਰ ਸਕਦੀ ਹੈ ਜਿਵੇਂ ਕਿ ਪਾਣੀ ਹੋ ਗਿਆ ਪਾਣੀ ਦੀ ਸਮੱਸਿਆ ਹੋ ਗਈ ਗੰਦੇ ਪਾਣੀ ਦੀ ਨਾਲੀ ਦੀ ਸਮੱਸਿਆ ਹੋ ਗਈ ਕੂੜੇ ਦੀ ਸਮੱਸਿਆ ਹੋ ਗਈ ਟੁੱਟੇ ਭੱਜੀ ਸੜਕ ਦੀ ਸਮੱਸਿਆ ਹੋ ਗਈ ਨਸ਼ੇ ਆਦਿ ਦੀ ਸਮੱਸਿਆ ਹੋ ਗਈ ਜਿਸ 'ਤੇ ਸਿਰਫ ਸਰਕਾਰ ਹੀ ਥੰਮ ਪਾ ਸਕਦੀ ਹੈ ਅਤੇ ਇਹ ਸਮੱਸਿਆ ਦਾ ਹੱਲ ਸਿਰਫ ਕੇਵਲ ਅਤੇ ਕੇਵਲ ਸਰਕਾਰ ਹੀ ਲੱਭ ਸਕਦੀ ਹੈ ਅਤੇ ਸਰਕਾਰ ਦੇ ਕੁੱਝ ਕਰਮਚਾਰੀ ਹੀ ਲੱਭ ਸਕਦੇ ਹਨ ਜਿਵੇਂ ਕਿ ਟੁੱਟੀ ਭੱਜੀ ਸੜਕਾਂ 'ਤੇ ਡਿੱਗਣ ਕਾਰਨ ਜਾਂ ਟੁੱਟ ਭੱਜੀ ਸੜਕਾਂ 'ਤੇ ਚੱਲਣ ਕਾਰਨ ਮੋਟਰਸਾਈਕਲ ਵਗੈਰਾ ਵੀ ਖਰਾਬ ਹੋ ਜਾਂਦੇ ਨੇ ਅਤੇ ਡਿੱਗਣ ਕਾਰਨ ਕਈਆਂ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ ਅਤੇ ਕਈ ਲੋਕਾਂ ਦੇ ਸੱਟ ਫੇਟ ਵੀ ਲੱਗ ਜਾਂਦੀ ਹੈ ਅਤੇ ਗੰਦੇ ਪਾਣੀ ਪੀਣ ਨਾਲ ਕਈ ਲੋਕਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ ਅਤੇ ਸਿਵਿਲ ਹਸਪਤਾਲ ਦੇ ਬਥੇਰੇ ਚੱਕਰ ਲੱਗਦੇ ਹਨ ਹਸਪਤਾਲਾਂ ਦੇ ਚੱਕਰ ਲੱਗਣ ਨਾਲ ਬੰਦੇ ਦੀ ਜਮ੍ਹਾਂ ਪੂੰਜੀ ਵੀ ਖਤਮ ਹੋ ਜਾਂਦੀ ਹੈ ਅਤੇ ਗੰਦਾ ਪਾਣੀ ਪੀਣ ਨਾਲ ਬੰਦੇ ਦਾ ਸਰੀਰ ਵੀ ਖਰਾਬ ਹੋ ਜਾਂਦਾ ਹੈ ਕੂੜਾ ਕਚਰਾ ਲੋਕੀ ਆਮ ਆਮ ਆਮ ਸੁੱਟਦੇ ਜਾਂਦੇ ਹਨ ਅਤੇ ਲੋਕੀ ਆਮ ਸ਼ਰੇਆਮ ਹੀ ਕੂੜਾ ਵਗੈਰਾ ਪਾਈ ਜਾਂਦੇ ਹਨ ਅਤੇ ਇੰਝ ਇੰਝ ਤਰ੍ਹਾਂ ਦੀ ਬਥੇਰੀ ਸਮੱਸਿਆਵਾਂ ਦਾ ਥੰਮ ਸਿਰਫ ਸਰਕਾਰ ਹੀ ਪਾ ਸਕਦੀ ਹੈ ਅਤੇ ਸਰਕਾਰ ਹੀ ਇਸ ਸਮੱਸਿਆ ਨੂੰ ਲੱਭ ਲੱਭ ਕੇ ਠੀਕ ਕਰਵਾ ਸਕਦੀ ਹੈ